ਮੈਨੂੰ ਯੂਟਿਊਬ ਉੱਤੇ ਆਰਟ ਐਂਡ ਕਰਾਫਟ ਦਾ ਬਹੁਤ ਸ਼ੌਂਕ ਸੀ ਜਿਸ ਕਰਕੇ ਮੈਂ ਛੋਟੀ ਉਮਰ ਵਿੱਚ ਹੀ ਆਪਣਾ ਯੂਟਿਊਬ ਚੈਨਲ ਬਣਾ ਲਿਆ ਸੀ ਜਿਸ ਵਿੱਚ ਮੈਂ ਆਪਣੀਆਂ ਆਰਟ ਐਂਡ ਕਰਾਫਟ ਦੀਆਂ ਜਾਣ ਜੋ ਵੀ ਮੈਂ ਡਰਾਇੰਗਸ ਬਣਾਉਂਦੀ ਸੀ ਉਹ ਆਪਣੀਆਂ ਯੂਟੀਊਬ ਚੈਨਲ ਉੱਤੇ ਅਪਲੋਡ ਕਰ ਦਿੰਦੀ ਸੀ ਫਿਰ ਮੈਨੂੰ ਹੌਲੀ ਹੌਲੀ ਜਦੋਂ ਕਲਾਵਾਂ ਬਾਰੇ ਪਤਾ ਲੱਗਿਆ ਤਾਂ ਮੈਂ ਸ਼ਿਲਪਕਾਰੀ ਫੁਲਕਾਰੀਆਂ ਵੀ ਬਣਾਉਣੀਆਂ ਸਟਾਰਟ ਕੀਤੀਆਂ ਜਿਨ੍ਹਾਂ ਨੂੰ ਵੀ ਮੈਂ ਆਪਣੇ ਯੂਟੀਊਬ ਦੇ ਚੈਨਲ ਉੱਤੇ ਅਪਲੋਡ ਕਰਦੀ ਸੀ ਅਸੀਂ ਯੂਟੀਊਬ ਉੱਤੇ ਚੈਨਲ ਬਣਾ ਸਕਦੇ ਹਾਂ ਆਪਣੇ ਆਰਟ ਐਂਡ ਕਰਾਫਟ ਲਈ ਜਾਂ ਸ਼ਿਲਪਕਾਰੀ ਫੁਲਕਾਰੀਆਂ ਦੀਆਂ ਵੀਡੀਓਜ ਦੇਖ ਸਕਦੇ ਹਾਂ ਕਿ ਆਪਾਂ ਉਹਨਾਂ ਨੂੰ ਕਿੱਦਾਂ ਬੁਣਨਾ ਹੈ ਕਿੱਦਾਂ ਬਣਾਉਣਾ ਹੈ ਪਰ ਅੱਜ ਦੇ ਟਾਈਮ ਵਿੱਚ ਇਹ ਕੋਈ ਵੀ ਨਹੀਂ ਕਰਦਾ ਆਪਾਂ ਅੱਜ ਦੇ ਟਾਈਮ ਦੇ ਯੰਗਸਟਰ ਨੂੰ ਕਿਵੇਂ ਆਪਾਂ ਉਸ ਚੀਜ਼ ਨਾਲ ਕਲਚਰ ਨਾਲ ਕਿੱਦਾਂ ਜੋੜ ਸਕਦੇ ਹਾਂ ਆਪਾਂ ਉਹਨਾਂ ਨੂੰ ਕਿਵੇਂ ਜੋੜ ਕੇ ਰੱਖ ਸਕਦੇ ਹਾਂ ਉਹਨਾਂ ਨੂੰ ਸ਼ਿਲਪਕਾਰੀ ਕਿਵੇਂ ਸਿਖਾ ਸਕਦੇ ਹਾਂ ਸੋਸ਼ਲ ਮੀਡੀਆ ਨੂੰ ਅਸੀਂ ਐਜ਼ ਆ ਵਰਕ ਯੂਜ਼ ਕਰ ਸਕਦੇ ਹਾਂ ਇਹਦੇ ਸਾਨੂੰ ਬਹੁਤ ਸਾਰੇ ਫ਼ਾਇਦੇ ਵੀ ਹਨ ਲੋਕਾਂ ਨੂੰ ਸੀਨਰੀਆਂ ਬਣਾ ਕੇ ਵੇਚ ਸਕਦੇ ਹਾਂ ਜਿਸ ਨਾਲ ਅਸੀਂ ਆਪਣੇ ਨਿੱਜੀ ਖਰਚੇ ਕੱਢ ਸਕਾਂਗੇ ਸ਼ਿਲਪ ਕਰਕੇ ਸ਼ਿਲਪਕਾਰੀ ਕਰਕੇ ਜਾਂ ਫੁਲਕਾਰੀ ਕੱਢ ਕੇ ਦੇ ਸਕਦੇ ਹਾਂ ਅਤੇ ਉਹਨਾਂ ਨੂੰ ਵੇਚ ਸਕਦੇ ਹਾਂ ਅਬਰੋਡ ਦੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਂਕ ਹੈ ਜੋ ਪੰਜਾਬੀ ਉੱਥੇ ਰਹਿੰਦੇ ਹਨ ਉਹ ਆਪਣੇ ਯੂਟੀਊਬ ਚੈਨਲ ਨਾਲ ਜੁੜ ਕੇ ਲੋਕਾਂ ਤੋਂ ਸ਼ਿਲਪਕਾਰੀ ਸਿੱਖ ਸਕਦੇ ਹਨ ਅਤੇ ਵੀਡੀਓਜ ਪਾ ਕੇ ਅਸੀਂ ਉਹਨਾਂ ਨੂੰ ਸ਼ਿਲਪਕਾਰੀ ਫੁਲਕਾਰੀਆਂ ਬੁਣਨੀਆਂ ਵੀ ਸਿਖਾ ਸਕਦੇ ਹਾਂ